ਰੋਜ਼ਾਨਾ ਜ਼ਿੰਦਗੀ ਦੇ ਝਮੇਲਿਆਂ ਕਰਕੇ ਮੈਂ ਗਾਉਣ ਨੂੰ ਸਮਾਂ ਨਹੀਂ ਸਮਰਪਿਤ ਕਰ ਸਕਦੀ ਮੈਂ ਆਪਣੇ ਕੁਛ ਸਹੇਲੀਆਂ ਨਾਲ ਮਿਲ ਕੇ ਗਾਉਣ ਦੀ ਕੋਸ਼ਿਸ਼ ਕਰਦੀ ਹਾਂ ਜਦੋਂ ਕਿਤੇ ਮੰਦਰ ਗੁਰਦੁਆਰੇ ਜਾਂਦੀ ਹਾਂ ਤਾਂ ਉਨ੍ਹਾਂ ਨਾਲ ਗੁਣ ਗੁਣਾ ਕੇ ਵੀ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ